ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਸ਼ਗਨ ਸਕੀਮ ਆਟਾ ਦਾਲ ਸਕੀਮ ਸ਼ਗਨ ਸਕੀਮ ਬਾਰੇ ਸ਼ਗਨ ਸਕੀਮ ਬਾਰੇ ਸਰਕਾਰ ਨੇ ਕੁੜੀਆਂ ਦੇ ਵਿਆਹ ਵਾਸਤੇ ਸ਼ਗਨ ਸਕੀਮ ਰੱਖੀ ਹੋਈ ਹੈ ਜਿਸ ਵਿੱਚ ਇਕੱਤੀ ਹਜ਼ਾਰ ਰੁਪਇਆ ਸ਼ਗਨ ਸਕੀਮ ਦਿੱਤੀ ਜਾਂਦੀ ਹੈ ਤਾਂ ਜੋ ਕੁੜੀਆਂ ਦਾ ਸ਼ਗਨ ਜੋ ਵੀ ਵਿਆਹ ਦਾ ਖ਼ਰਚਾ ਦਾਜ ਦਹੇਜ ਦਾ ਖ਼ਰਚਾ ਹੁੰਦਾ ਉਹ ਹੋ ਸਕੇ ਕੁਝ ਨਾ ਕੁਝ ਸਰਕਾਰ ਮਦਦ ਕਰਦੀ ਹੈ ਅਤੇ ਆਟਾ ਦਾਲ ਸਕੀਮ ਗਰੀਬਾਂ ਵਾਸਤੇ ਪੰਜਾਬ ਸਰਕਾਰ ਨੇ ਆਟਾ ਦਾਲ ਸਕੀਮ ਚਲਾਈ ਹੋਈ ਹੈ ਜਿਸ ਵਿੱਚ ਦੋ ਰੁਪਏ ਕਿੱਲੋ ਆਟਾ ਮਿਲਦਾ ਹੈ ਥੈਂਕ ਯੂ